ਪਸ਼ੂਆਂ ਦੀ ਦੇਖਭਾਲ ਪਸ਼ੂਆਂ ਦੀ ਦੇਖਭਾਲ ਬਹੁਤ ਹੀ ਵਧੀਆ ਤਰੀਕੇ ਨਾਲ਼ ਕੀਤੀ ਜਾਂਦੀ ਹੈ ਘਰ ਵਿੱਚ ਰੱਖੇ ਪਸ਼ੂਆਂ ਦੀ ਦੇਖਭਾਲ ਸਾਰਾ ਦਿਨ ਸਵੇਰੇ ਉਹਨਾਂ ਨੂੰ ਉੱਠ ਕੇ ਚਾਰਾ ਪਾਇਆ ਜਾਂਦਾ ਹੈ ਹਰਾ ਘਾਹ ਪਾਇਆ ਜਾਂਦਾ ਹੈ ਜਿਵੇਂ ਕਿ ਦੇਸੀ ਫੀਡ ਦਾਣਾ ਪਾਇਆ ਜਾਂਦਾ ਹੈ ਅਤੇ ਫਿਰ ਉਹਨਾਂ ਦਾ ਦੁੱਧ ਚੋਇਆ ਜਾਂਦਾ ਹੈ ਅਤੇ ਉਹਨਾਂ ਨੂੰ ਨਲ੍ਹਾ ਧਲ਼ਾ ਕੇ ਉਹਨਾਂ ਦੇ ਕਿੱਲੇ 'ਤੇ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਫਿਰ ਦੁਪਹਿਰ ਵੇਲੇ ਉਹਨਾਂ ਨੂੰ ਹਰਾ ਚਾਰਾ ਪਾਇਆ ਜਾਂਦਾ ਹੈ ਅਤੇ ਪਾਣੀ ਪਿਲਾਇਆ ਜਾਂਦਾ ਹੈ ਸ਼ਾਮ ਨੂੰ ਫੇ ਸ਼ਾਮ ਨੂੰ ਉਹਨਾਂ ਨੂੰ ਦਾਣਾ ਫੀਡ ਪਾ ਕੇ ਦੁੱਧ ਚੋਇਆ ਜਾਂਦਾ ਹੈ ਅਤੇ ਕੁਝ ਲੋਕ ਪਸ਼ੂਆਂ ਨੂੰ ਬਾਹਰ ਚਰਾਉਣ ਲਈ ਲੈ ਕੇ ਜਾਂਦੇ ਹਨ ਅਤੇ ਉਨ੍ਹਾਂ ਦੀ ਵਧੀਆ ਤਰੀਕੇ ਨਾਲ ਦੇਖਭਾਲ ਕਰਦੇ ਹਨ ਅਤੇ ਪਸ਼ੂਆਂ ਅਤੇ ਪਸ਼ੂਆਂ ਦੇ ਹੋਏ ਬੱਚਿਆਂ ਦੀ ਵੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਵੀ ਉੱਦਾਂ ਹੀ ਵੱਡੇ ਕਰਕੇ ਪਾਲ਼ਿਆ ਜਾਂਦਾ ਹੈ ਅਤੇ ਫੇਰ ਉਨ੍ਹਾਂ ਦੀ ਵੀ ਉਨ੍ਹਾਂ ਦੇ ਮ ਉਨ੍ਹਾਂ ਦੇ ਵਾ ਵਾਂਗੂ ਹੀ ਉਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਪਸ਼ੂਆਂ ਦਾ ਦੁੱਧ ਚੋਇਆ ਜਾਂਦਾ ਹੈ ਪਰ ਉਹਨੂੰ ਹਰਾ ਘ ਘਾਹ ਅਤੇ ਚਾਰਾ ਦਾਣਾ ਫੀਡ ਇਹ ਸਭ ਕੁਝ ਪਾਇਆ ਜਾਂਦਾ ਹੈ ਅਤੇ ਉਹਨਾਂ ਦੀ ਵਧੀਆ ਤਰੀਕੇ ਨਾਲ਼ ਦੇਖਭਾਲ ਕੀਤੀ ਜਾਂਦੀ ਹੈ